ਇੱਕ ਮਹੀਨਾ ਪਹਿਲਾਂ ਮੈਂ ਚਾ ਨਵਾਂ ਚਾਰਜਰ ਮੰਗਵਾਇਆ ਇਹ ਸੋਚ ਕੇ ਕਿ ਸ਼ਾਇਦ ਓਨਲਾਈਨ ਪ੍ਰੋਜੈਕਟ ਵਧੀਆ ਨਿਕਲਦੇ ਹਨ ਕਿਉਂਕਿ ਮੈਂ ਹਮੇਸ਼ਾ ਹੀ ਆਫਲਾਈਨ ਚੀਜ਼ਾਂ ਪਰਚੇਸ ਕੀਤੀਆਂ ਹਨ ਜੋ ਕਿ ਮੈਨੂੰ ਹਮੇਸ਼ਾ ਹੀ ਫਾਇਦੇਮੰਦ ਦਿੰਦੀਆਂ ਹਨ ਪਰ ਕਿਸੇ ਦੋਸਤ ਦੇ ਕਹਿਣ 'ਤੇ ਮੈਂ ਇੱਕ ਓਨਲਾਈਨ ਚਾਰਜਰ ਮੰਗਵਾ ਲਿਆ ਪਰ ਮੈਨੂੰ ਬਹੁਤ ਹੀ ਘਟੀਆ ਹੀ ਮੇਰਾ ਐਕਸਪੀਰੀਅੰਸ ਰਿਹਾ ਉਹ ਚਾਰਜਰ ਮੰਗਵਾ ਕੇ ਐਕਚੁਲੀ ਹੋਇਆ ਇਹ ਕਿ ਸੋਲ੍ਹਾਂ ਸਤੰਬਰ ਨੂੰ ਮੈਂ ਮੇਰੇ ਘਰ ਚਾਰਜਰ ਆਇਆ ਜਦੋਂ ਮੈਂ ਫੋਨ ਨੂੰ ਚਾਰਜਿੰਗ 'ਤੇ ਲਾਇਆ ਤਾਂ ਪਹਿਲਾਂ ਤਾਂ ਚਾਰਜ ਬਹੁਤ ਹੀ ਸਲੋਅ ਹੁੰਦਾ ਸੀ ਅਤੇ ਨਾਲ ਹੀ ਉਹ ਅੱਧੇ ਘੰਟੇ ਵਿੱਚ ਹੀ ਇੰਨਾ ਕੁ ਗਰਮ ਹੋ ਗਿਆ ਕਿ ਮੈਨੂੰ ਐਵੇਂ ਲੱਗਿਆ ਕਿ ਜਿਵੇਂ ਮੇਰਾ ਫੋਨ ਹੀ ਸੜ ਜਾਏਗਾ ਫਿਰ ਮੈਂ ਪੈ ਕੰਪਲੇਂਟ ਵੀ ਪਾਈ ਚਾਰਜਿੰਗ ਦੇ ਸੈਂਟਰ ਵਿੱਚ ਪਰ ਕੋਈ ਫਰਕ ਨਹੀਂ ਪਿਆ ਉਹਨਾਂ ਨੇ ਮੇਰਾ ਚਾਰਜਰ ਵੀ ਰਿਪਲੇਸ ਨਹੀਂ ਕੀਤਾ ਨਾਲ ਹੀ ਨਾਲ ਕਿ ਜਦੋਂ ਮੈਂ ਉਹਦੇ ਚਾਰਜਿੰਗ ਪੁਆਇੰਟ ਨੂੰ ਟੱਚ ਕੀਤਾ ਤਾਂ ਉਹਦੀ ਜਿਹੜਾ ਅਡੈਪਟਰ ਸੀ ਉਹ ਵੀ ਘਟੀਆ ਸੀ ਉਹ ਇੱਕ ਵਰੀ ਥੱਲੇ ਡਿਗ ਕੇ ਟੁੱਟ ਵੀ ਗਿਆ ਜੋ ਕਿ ਇੰਨਾ ਗੰਦਾ ਮਟੀਰੀਅਲ ਲੱਗਿਆ ਹੋਇਆ ਸੀ ਉਹ 'ਤੇ ਕਿ ਮੇਰਾ ਤਾਂ ਵਿਸ਼ਵਾਸ ਹੀ ਉੱਠ ਗਿਆ ਕਿ ਐਜੀ ਕੋਈ ਵੀ ਚੀਜ਼ ਕਦੇ ਓਨਲਾਈਨ ਨਹੀਂ ਮੰਗਾਉਣੀ ਚਾਹੀਦੀ ਬਿਨਾਂ ਵੇਖੇ ਅਤੇ ਸਮਝੇ ਹਰ ਚਾਰਜਰ ਹਰ ਇਲੈਕਟਰੋਨਿਕ ਆਈਟਮ ਦੀ ਕੋਈ ਨਾ ਕੋਈ ਗਰੰਟੀ ਵਾਰੰਟੀ ਜ਼ਰੂਰ ਹੁੰਦੀ ਹੈ ਪਰ ਇਹਦੀ ਦੀ ਗਰੰਟੀ ਤਾਂ ਹੈਗੀ ਨਹੀਂ ਸੀ ਅਤੇ ਵਾਰੰਟੀ ਵੀ ਸਿਰਫ ਤਿੰਨ ਮਹੀਨਿਆਂ ਦੀ ਉਹ ਵੀ ਆਪ ਕੰਪਨੀ ਵਾਲੇ ਬਿਲਕੁਲ ਵੀ ਨਹੀਂ ਚੇਂਜ ਕਰ ਸਕੇ ਉਹ ਬਸ ਮੈਨੂੰ ਵਾਰੀ ਵਾਰੀ ਐਵੇਂ ਗੱਲਾਂ 'ਚ ਲਾਈ ਗਏ ਕਿ ਅਸੀਂ ਕਰ ਦਵਾਂਗੇ ਕਰ ਦਵਾਂਗੇ ਪਰ ਅੱਜ ਦੋ ਮਹੀਨਿਆਂ ਬਾਅਦ ਕੋਈ ਵੀ ਘਰ ਨਹੀਂ ਆਇਆ ਉਹਨੂੰ ਬਦਲਣ ਵਾਸਤੇ ਮੈਂ ਬਹੁਤ ਵਾਰੀ ਕੰਪਲੇਂਟ ਵੀ ਪਾਈ ਪਰ ਉਹਨਾਂ ਨੂੰ ਕੋਈ ਅਸਰ ਨਹੀਂ ਹੋਇਆ ਉਹਦਾ ਅਡੈਪਟਰ ਬਹੁਤ ਜ਼ਿਆਦਾ ਵੀਕ ਸੀ ਅਤੇ ਜਦੋਂ ਮੈਂ ਉਹਨੂੰ ਆਪਦੀਆਂ ਉਂਗਲਾਂ ਨਾਲ ਉਹਦੀ ਤਾਰ ਨੂੰ ਮਾੜਾ ਕੁ ਮੋੜਿਆ ਤਾਂ ਉਹ ਤਾਰ ਵੀ ਟੁੱਟਣ ਵਰਗੀ ਹੋ ਗਈ ਅਤੇ ਬਹੁਤ ਹੀ ਘਟੀਆ ਚੀਜ਼ ਮਿਲੀ ਮੈਨੂੰ ਮੈਂ ਬਿਲਕੁਲ ਵੀ ਸੈਟੀਸਫਾਈ ਨਹੀਂ ਹੋਈ ਇਸ ਚੀਜ਼ 'ਚ ਨੂੰ ਪਰਚੇਜ਼ ਕਰਕੇ ਤਾਂ ਹੁਣ ਮੈਂ ਕਦੇ ਵੀ ਓਨਲਾਈਨ ਸ਼ੋਪਿੰਗ ਨਹੀਂ ਕਰਾਂਗੀ ਵੈਸੇ ਵੀ ਇਲੈਕਟਰੋਨਿਕ ਆਈਟਮਸ ਤਾਂ ਹੁੰਦੀਆਂ ਹੀ ਐਵੇਂ ਨੇ ਪਰ ਕੋਈ ਚੀਜ਼ ਵਧੀਆ ਵੀ ਨਿਕਲ ਜਾਂਦੀ ਹੈ ਪਰ ਇਹ ਚਾਰਜਰ ਨੇ ਤਾਂ ਬਿਲਕੁਲ ਹੀ ਮੈਨੂੰ ਡਿਸਅਪੋਇੰਟ ਜਿਹਾ ਕਰ ਦਿੱਤਾ